ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ ਅਸੀਂ ਬਚਪਨ ਵਿੱਚ ਖੇਡਾਂ ਖੇਡਦੇ ਹਨ ਖੋ ਖੋ ਕੋਟਲਾ ਛਪਾਕੀ ਹੈ ਜਿਵੇਂ ਹੋਰ ਸਾਰੀਆਂ ਖੇਡਾਂ ਖੇਡਦੇ ਹਾਂ ਅਸੀਂ ਪੰਜਾਬ ਵਿੱਚ ਬਹੁਤ ਸਾਰੀਆਂ ਖੇਡਾਂ ਸਿੱਖੀਆਂ ਅਤੇ ਖੇਡਦੇ ਹਾਂ ਸਾਡਾ ਪੰਜਾਬ ਦਾ ਕਲਚਰ ਬਹੁਤ ਵਧੀਆ ਹੈ ਸਾਨੂੰ ਉਹ ਪੰਜਾਬ ਵਿੱਚ ਕਈ ਖੇਡਾਂ ਖੇਡਦਿਆਂ ਸਿੱਖਣ ਨੂੰ ਮਿਲਦੀਆਂ ਹਨ ਜਿਵੇਂ ਵਾਲੀਬਾਲ ਫੁੱਟਬਾਲ ਚਿੜੀ ਛਿੱਕਾ ਇੱਦਾਂ ਦੀਆਂ ਅਸੀਂ ਖੇਡਾਂ ਖੇਡਦੇ ਹਾਂ ਅਸੀਂ ਪੰਜਾਬ ਵਿੱਚ ਰਹਿ ਕੇ ਬਹੁਤ ਕੁਝ ਸਿੱਖਦੇ ਹਾਂ ਸਾਡੇ ਸਕੂਲਾਂ ਵਿੱਚ ਵੀ ਕਈ ਖੇਡਾਂ ਖਿਡਾਈਆਂ ਜਾਂਦੀਆਂ ਸਨ ਅਸੀਂ ਫਿਜੀਕਲ ਵਿੱਚ ਸਕੂਲ ਵਿੱਚ ਫਿਜੀਕਲ ਕਰਦੇ ਹਾਂ ਅਤੇ ਉਹਦੇ ਉਸ ਵਿੱਚ ਵੀ ਖੇਡਾਂ ਖਿਡਾਈਆਂ ਜਾਂਦੀਆਂ ਹਨ ਖੋ ਖੋ ਵਾਲੀਬਾਲ ਹੋਰ ਵੀ ਖੇਡਾਂ ਖੇਡੀਆਂ ਜਾਂਦੀਆਂ ਹਨ ਤਾਂ ਕਿ ਅਸੀਂ ਖੇਡਾਂ ਖੇਡਾਂ ਸਿੱਖ ਕੇ ਅਸੀਂ ਬਹੁਤ ਸਾਰੀਆਂ ਕਰਦੇ ਹਾਂ ਸਾਨੂੰ ਖੇਡਾਂ ਸਿੱਖ ਕੇ ਖੇਡਾਂ ਵਿੱਚ ਖਿਡਾਰੀ ਵੀ ਬਣਨਾ ਪਸੰਦ ਹੈ ਅਸੀਂ ਪੰਜਾਬ ਦਾ ਨਾਮ ਰੌਸ਼ਨ ਕਰ ਸਕਦੇ ਹਾਂ ਇਹੀ ਖੇਡਾਂ ਖੇਡ ਕੇ ਤਾਂ ਕਿ ਅਸੀਂ ਪੰਜਾਬ ਵਿੱਚ ਆਪਣੇ ਕਲਚਰ ਨੂੰ ਵਧਾ ਸਕੀਏ ਪੰਜਾਬੀ ਅਸੀਂ ਪੰਜਾਬੀਆਂ ਨੂੰ ਅਸੀਂ ਪੰਜਾਬ ਵਿੱਚ ਰਹਿ ਕੇ ਇਹ ਸਾਰੀਆਂ ਖੇਡਾਂ ਸਿੱਖ ਸਕਦੇ ਹਾਂ ਪੰਜਾਬ 'ਚ ਸਕੂਲਾਂ ਵਿੱਚ ਰਹਿ ਸਕੂਲ 'ਚ ਵੀ ਸਾਨੂੰ ਕਾਫੀ ਟਾਈਮ ਮਿਲਦਾ ਹੈ ਕਿ ਅਸੀਂ ਫਿਜੀਕਲ ਵਿੱਚ ਕਾਫੀ ਸਾਰੀਆਂ ਗੇਮਾਂ ਖੇਡ ਸਕਦੇ ਹਾਂ ਸਾਨੂੰ ਮੌਕਾ ਮਿਲਦਾ ਹੈ ਸਾਨੂੰ ਕਦੇ ਵੀ ਇਹ ਮੌਕਾ ਗੁਆਉਣਾ ਨਹੀਂ ਚਾਹੀਦਾ ਸਾਨੂੰ ਹਰ ਇੱਕ ਖੇਡ ਆਉਣੀ ਚਾਹੀਦੀ ਹੈ